ਮਾਰਸਲ ਆਰਟਸ ਦੇ ਵਿੱਚ ਅਸੀਂ ਜਿਹਨਾਂ ਨੂੰ ਪ੍ਰੇਰਿਤ ਜਾਂ ਸ਼ਕਤੀਸ਼ਾਲੀ ਦੇਖਿਆ ਦੇਖੋ ਅੱਜ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਆਪਣੇ ਸਾਰੇ ਵਰਡ ਦੇ ਵਿੱਚ ਮਾਰਸ਼ਲ ਆਰਟਸ ਦੀ ਬਹੁਤ ਮਹੱਤਤਾ ਮਾਰਸਲ ਆਰਟਸ ਇੱਕ ਇੱਦਾਂ ਦੀ ਚੀਜ਼ ਆ ਗਈ ਅਗਰ ਹਰੇਕ ਬੰਦਾ ਸਿੱਖ ਜਾਂਦਾ ਤਾਂ ਇੱਕ ਤਰ੍ਹਾਂ ਦਾ ਉਹ ਸ਼ਕਤੀਸ਼ਾਲੀ ਬਣ ਜਾਂਦਾ ਸ਼ਕਤੀਸ਼ਾਲੀ ਕਿਵੇਂ ਦੇਖੋ ਤੁਸੀਂ ਅੱਜ ਕੱਲ੍ਹ ਬੈਕ 'ਤੇ ਜਾ ਰਹੇ ਹਾਂ ਅਸੀਂ ਕੋਈ ਮੋਟਰਸਾਈਕਲ ਖੋਹ ਰਿਹਾ ਰੋਕ ਕੇ ਕੋਈ ਲੇਡੀਜ ਔਰਤ ਜਾ ਰਹੀ ਆ ਉਹਦੇ ਗਲੇ ਦੇ ਵਿੱਚੋਂ ਕੀ ਆ ਚੈਨੀ ਖੋਹ ਲਈ ਘਰਾਂ ਦੇ ਵਿੱਚ ਕੀ ਅੱਜ ਕੋਈ ਬਜ਼ੁਰਗ ਬੰਦਾ ਬੈਠਾ ਉਹਦੇ 'ਤੇ ਕੀ ਆ ਹਮਲਾ ਕਰਦੇ ਆ ਉਹ ਤੋਂ ਸਾਰਾ ਕੁਝ ਕੀ ਆ ਲੁੱਟ ਖੋਹ ਕੇ ਚਲੇ ਜਾਂਦੇ ਆ ਇਹ ਮਾਰਸਲ ਆਰਟਸ ਇਹਨੂੰ ਅੱਜ ਕੱਲ੍ਹ ਸਰਕਾਰ ਨੇ ਬਹੁਤ ਮਹੱਤਤਾ ਦਿੱਤੀ ਹੈ ਬੱਚਿਆਂ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਹੈਗੇ ਆ ਵੀ ਇਹਦੀ ਤਕਨੀਕ ਕੀ ਆ ਹਰੇਕ ਬੰਦੇ ਨੂੰ ਆਉਣੀ ਚਾਹੀਦੀ ਆ ਜਿਵੇਂ ਦੇਖੋ ਜੁੱਡੋ ਕਰਾਟੇ ਹੋ ਗਏ ਆ ਅਗਰ ਇਹ ਸਹੀ ਤਰੀਕੇ ਦੇ ਨਾਲ ਸਿੱਖ ਜਾਂਦਾ ਬੰਦਾ ਤਾਂ ਬਿਨਾਂ ਹਥਿਆਰ ਤੋਂ ਕੀ ਆ ਉਹ ਜਿਹੜਾ ਤੁਹਾਡੇ 'ਤੇ ਅਟੈਕ ਕਰ ਰਿਹਾ ਉਹਦੇ ਨਾਲ ਕੀ ਆ ਲੜ ਸਕਦਾ ਹੈ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਸਕਦਾ ਅਗਰ ਤੁਹਾਨੂੰ ਸਹੀ ਟਕਨੀਕ ਆਉਂਦੀ ਆ ਤਾਂ ਤੁਸੀਂ ਦੂਜਿਆਂ ਨੂੰ ਜਿਹਨਾਂ ਨੇ ਟ੍ਰੇਨਿੰਗ ਕੀਤੀ ਆ ਦੇਖਿਆ ਹੋਣਾ ਉਹ ਕਿੰਨੇ ਪ੍ਰੇਰਿਤ ਨੇ ਕਿੰਨੇ ਸ਼ਕਤੀਸ਼ਾਲੀ ਆ ਉਹ ਉਹਨਾਂ ਦੇ ਵਿੱਚ ਕਿੰਨਾ ਜੋਸ਼ ਆ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਕਲਾ ਹੈਗੀ ਆ ਸ਼ਕਤੀ ਆ ਗਈ ਆ ਵੀ ਸਾਡੇ ਕੋਲ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਆ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਛੋਟੇ ਛੋਟੇ ਬੱਚੇ ਦੇਖੋ ਅੱਜ ਟੀਵੀ ਦੇ ਵਿੱਚ ਇਹ ਜਿਹੀਆਂ ਗੇਮਾਂ ਜੂਡੋ ਕਰਾਟੇ ਦਿਖਾ ਰਹੇ ਨੇ ਉਹਨੂੰ ਦੇਖ ਕੇ ਕੀ ਉਹ ਸ਼ਕਤੀਸ਼ਾਲੀ ਮੋਟੀਵੇਟ ਹੋ ਰਹੇ ਨੇ ਪ੍ਰੇਰਿਤ ਹੋ ਰਹੇ ਨੇ ਉਹ ਵੀ ਟੀਵੀ ਦੇਖ ਕੇ ਕੀ ਆ ਇਹ ਜਿਹੀਆਂ ਐਕਸਰਸਾਈਜ਼ਾਂ ਕਰਦੇ ਆ ਜਿਹੜਾ ਮਾਰਸਲ ਆਰਟਸ ਆ ਜ਼ਰੂਰੀ ਆ ਇਹ ਆਪਣੀ ਸੇਫਟੀ ਵਾਸਤੇ ਹਰੇਕ ਕੁੜੀ ਮੁੰਡੇ ਨੂੰ ਇਹ ਆਉਣਾ ਚਾਹੀਦਾ ਅਤੇ ਅਸੀਂ ਜਿਹੜੇ ਬੱਚਿਆਂ ਨੂੰ ਕੋਚਿੰਗ ਕੀਤਾ ਸੀ ਉਹਨਾਂ ਦੇ ਵਿੱਚ ਅਸੀਂ ਇਹ ਗੁਣ ਦੇਖਿਆ ਸ਼ਕਤੀ ਦੇਖੀ ਪਹਿਲੇ ਦਿਨ ਉਹਨਾਂ ਨੂੰ ਕੁਛ ਪਤਾ ਨਹੀਂ ਸੀ ਜਦੋਂ ਉਹਨਾਂ ਨੂੰ ਸਿਖਾਇਆ ਗਿਆ ਕੋਚਿੰਗ ਦਿੱਤੀ ਗਈ ਉਹਨਾਂ ਨੇ ਅਭਿਆਸ ਕੀਤਾ ਟ੍ਰੇਨਿੰਗ ਲਈ ਟ੍ਰੇਨਿੰਗ ਦੇ ਵਿੱਚ ਵਧੀਆ ਸਿੱਖਿਆ ਉਹਨਾਂ ਨੇ ਉਹਨਾਂ ਦੇ ਵਿੱਚ ਕੀ ਹੈ ਬਹੁਤ ਹੀ ਸ਼ਕਤੀਸ਼ਾਲੀ ਦੇਖਣ ਨੂੰ ਮਿਲੀ ਆ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆਟਸ ਮਾਰਸ਼ਲ ਆਰਟਸ ਆ ਇਹ ਹੋਰ ਵੀ ਜਿਹੜੇ ਬੱਚੇ ਹੈਗੇ ਜਾਂ ਵੱਡੇ ਮੁੰਡੇ ਹੈਗੇ ਉਹਨੂੰ ਇਹ ਸਿੱਖਣ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਰਸਤੇ ਦੇ ਵਿੱਚ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਵੀ ਇਹ ਕਰਾਇਮ ਵਧਿਆ ਉਹਨੂੰ ਕੀ ਆ ਤੁਸੀਂ ਅਗਰ ਵਧੀਆ ਟਕਨੀਕ ਦੇ ਨਾਲ ਇਹ ਸਿੱਖਿਆ ਇਹ ਕੋਚਿੰਗ ਲਈ ਆ ਉਹਦੇ 'ਤੇ ਤੁਸੀਂ ਕਾਬੂ ਪਾ ਸਕਦੇ ਹੋ ਅਸੀਂ ਜਿਹੜੇ ਬੱਚਿਆਂ ਨੂੰ ਕੋਚਿੰਗ ਦਿੱਤੀ ਆ ਸਿਖਾਇਆ ਉਹਨਾਂ ਦਾ ਅੱਜ ਅਸੀਂ ਮਨੋਬਲ ਦੇਖਿਆ ਵੀ ਉਹਨਾਂ ਕੋਲ ਬਹੁਤ ਹੀ ਉਹ ਪ੍ਰੇਰਿਤ ਹੋਏ ਨੇ ਇਹ ਟ੍ਰੇਨਿੰਗ ਤੋਂ ਸ਼ਕਤੀ ਆਈ ਆ ਉਹਨਾਂ ਦੇ ਵਿੱਚ ਇਹ ਗੱਲਾਂ ਬਹੁਤ ਹੀ ਵਧੀਆ ਲੱਗੀਆਂ ਜਦੋਂ ਉਹਨਾਂ ਨੇ ਸਾਨੂੰ ਆਪਣਾ ਪ੍ਰਦਰਸ਼ਨ ਦਿਖਾਇਆ ਸ਼ਕਤੀ ਦਿਖਾਈ ਇਹ ਗੱਲਾਂ ਕਰਦੇ ਹੋਏ ਤੁਹਾਡਾ ਧੰਨਵਾਦ ਕਰਦੇ ਹਾਂ